ਖੇਤੀਬਾੜੀ ਵਾਲੇ ਖੇਤਰਾਂ ਵਿੱਚ ਅਕਸਰ ਕਈ ਤਰ੍ਹਾਂ ਦੇ ਪੰਛੀ ਦਿਖਾਈ ਦਿੰਦੇ ਹਨ ਜੋ ਕਟੀ ਪਤੰਗਾਂ ਦੇ ਖਾਣੇ ਅਨਾਜ ਚੂਨਾ ਜਾਂ ਘੋਂਸਲੇ ਬਣਾਉਣ ਲਈ ਆ ਜਾਂਦੇ ਹਨ ਜਿਵੇਂ ਕਿ ਮੈਨਾ ਕੀਟ ਅਤੇ ਅਨਾਜ ਦੋਨੋਂ ਖਾਂਦੀ ਹੈ ਤੋਤਾ ਖਾਸ ਕਰ ਬਾਜਰਾ ਮੱਕੀ ਅਤੇ ਗੇਹੂੰ ਖਾਂਦਾ ਹੈ ਗੋਰਿਆ ਛੋਟੇ ਛੋਟੇ ਬੀਜ ਅਤੇ ਕੀਟ ਖਾਂਦੀ ਹੈ ਕਬੂਤਰ ਖੇਤਾਂ ਅਤੇ ਅਨਾਜ ਭੰਡਾਰ ਰਹਿਣ ਵਾਲੇ ਜਗ੍ਹਾਵਾਂ ਵਿੱਚ ਪਾਇਆ ਜਾਂਦਾ ਹੈ ਕਊਆ ਬੁਲਬੁਲ ਨੀਲਕੰਠ ਬਾਜ ਅਤੇ ਚੀਲ ਛੋਟੇ ਛੋਟੇ ਛੋਟੇ ਜਗ੍ਹਾਵਾਂ 'ਤੇ ਕਦੀ ਖਤਮ ਹੀ ਨਹੀਂ ਹੁੰਦੇ ਬਟੇਰ ਇਹ ਸਾਰੇ ਪੰਛੀ ਸਾਡੇ ਖੇਤਰ ਵਿੱਚ ਪਾਏ ਜਾਂਦੇ ਹਨ